ਹਾਂਜੀ ਤੁਸੀਂ ਗੁਰਪ੍ਰੀਤ ਬੋਲਦੇ ਹੋ ਸਟੇਸ਼ਨ ਤੋਂ ਹਾਂਜੀ ਐ ਇੱਦਾਂ ਹੈ ਕਿ ਮੈਂ ਇੱਥੇ ਆਪਣਾ ਘੁੰਮਣ ਵਾਸਤੇ ਆ ਰਹੀ ਹਾਂ

ਹਾਂਜੀ ਹਾਂਜੀ ਹਾਂਜੀ ਅਤੇ ਅਸੀਂ ਮਤਲਬ ਤੁਸੀਂ ਮੈਨੂੰ ਦੱਸ ਸਕਦੇ ਕੇ ਆਪਣਾ ਤਰਨਤਾਰਨ ਜਿਲ੍ਹੇ ਦੇ ਸਟੇਸ਼ਨ ਤੋਂ ਤੋਂ ਮਤਲਬ ਟਰਾਈ ਟਰੇਨਾਂ ਵਗੈਰਾ ਕਿੱਧਰ ਕਿੱਧਰ ਨੂੰ ਜਾਂਦੀਆਂ ਜੇ ਤੁਸੀਂ ਕਿੱਥੋਂ ਤੱਕ ਮੈਨੂੰ ਘੁੰਮਾ ਸਕਦੇ ਹੋ ਪਲੀਜ਼ ਜਰਾ ਦੱਸੋ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅਸੀਂ ਮਤਲਬ ਘੁੰਮਣਾ ਚਾਹਾਂਗੇ ਅਤੇ ਆਪਣਾ ਤਰਨਤਾਰਨ ਦਰਬਾਰ ਸਾਹਿਬ ਵੀ ਜਾਵਾਂਗੇ ਗੋਲਡਨ ਟੈਂਪਲ ਵੀ ਜਾਵਾਂਗੇ ਅਤੇ ਇੱਥੇ ਸਾਡੇ ਲਾਗੇ ਬਾਬਾ ਬੁੱਢਾ ਸਾਹਿਬ ਆ ਅਸੀਂ ਉੱਥੇ ਵੀ ਜਾਵਾਂਗੇ ਛੇਹਰਟਾ ਸਾਹਿਬ ਹੈ ਸੰਨ ਸਾਹਿਬ ਅਸੀਂ ਇੱਧਰ ਸਾਰੇ ਇਲਾਕੇ 'ਚ ਘੁੰਮਣਾ ਚਾਹੁੰਦੇ ਕਿਉਕਿ ਅਸੀਂ ਪਹਿਲੀ ਵਾਰ ਆਏ ਹਾਂ ਨਾ ਅਤੇ ਅਸੀਂ ਮੁੜ ਕੇ ਵਾਪਿਸ ਫਿਰ ਜਾਣ ਦਾ ਵੀ ਸਾਨੂੰ ਐਂ ਨਾ ਵੀ ਜੇ ਵਾਪਸ ਵੀ ਜਾਣਾ ਚਾਹੁੰਦੇ ਹਾਂ ਤਾਂ ਤੁਹਾਨੂੰ ਟਾਈਮ ਟੇਬਲ ਜੇ ਪਤਾ ਹੋਵੇ ਤਾਂ ਤੁਸੀਂ ਸਾਨੂੰ ਦੱਸ ਦਿਓ

ਹਾਂਜੀ ਹਾਂਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਫਿਰ ਅਸੀਂ ਇਕੱਲੇ ਹੀ ਆਏ ਹੋਏ ਨਾ ਫਿਰ ਥੋੜ੍ਹਾ ਹੁੰਦਾ ਵੀ ਟਾਈਮ ਨਾਲ ਬੰਦਾ ਵਾਪਿਸ ਚਲਾ ਜਾਵੇ ਮਾਹੌਲ ਵੀ ਸਹੀ ਨਹੀਂ ਹੈਗੇ ਹਾਂਜੀ ਹਾਂਜੀ ਠੀਕ ਹੈ ਜੀ ਮੇਹਰਬਾਨੀ